ਸਤਿ ਸ਼੍ਰੀ ਅਕਾਲ ਵੀਰ ਜੀ ਜੀ ਤੁਸੀਂ ਓਲਾ ਤੋਂ ਡਰਾਈਵਰ ਮਨਜੀਤ ਸਿੰਘ ਬੋਲਦੇ ਜੇ ਹਾਂਜੀ ਭਾਅ ਜੀ ਭਾਅ ਜੀ ਅਸੀਂ ਤੁਹਾਡੀ ਗੱਡੀ ਬੁੱਕ ਕੀਤੀ ਸੀਗੀ ਹਾਂਜੀ ਹਾਂਜੀ ਘੁੰਮਣ ਫਿਰਨ ਜਾਣ ਵਾਸਤੇ ਡਲਹੋਜੀ ਹਾਂਜੀ ਵੀਰ ਜੀ ਕਾਫ਼ੀ ਦੇਰ ਤੋਂ ਆਪਾਂ ਇੰਤਜ਼ਾਰ ਕਰਨ ਡਹੇ ਆਂ ਕਾਫ਼ੀ ਉਡੀਕ ਕਰਦੀ ਤੁਹਾਡੀ ਅਤੇ ਤੁਸੀਂ ਇਸ ਸਮੇਂ ਕਿਹੜੀ ਜਗ੍ਹਾ ਜੇ ਤੇ ਅਤੇ ਕਿੰਨੇ ਦੇਰ ਦੇ ਵਿੱਚ ਸਾਡੇ ਕੋਲ ਪਹੁੰਚੋਗੇ ਹਾਂਜੀ ਇਹ ਦੱਸੋ ਤਾਂ ਕਿ ਆਪਾਂ ਵੇਟ ਨਾ ਕਰਨੀ ਪਵੇ ਤੁਹਾਡੀ ਅਤੇ ਬੱਚੇ ਸਾਰੇ ਤਿਆਰ ਹੋ ਕੇ ਬੈਠੇ ਆ ਇੰਤਜ਼ਾਰ ਕਰਨ ਡੇ ਆ ਤੁਹਾਡੀ ਜੀ ਕਾਫ਼ੀ ਦੇਰ ਤੋਂ ਅਤੇ ਹੁਣ ਆਪਾਂ ਨੂੰ ਨਿੱਜੀ ਸਥਾਨ ਦੱਸੋ ਅਤੇ ਕਿੱਥੇ ਜੇ ਅਤੇ ਕਿੰਨੇ ਦੇਰ ਦੇ ਵਿੱਚ ਸਾਡੇ ਕੋਲ ਆਓਗੇ ਤਾਂ ਕਿ ਕੋਈ ਖੱਜਲ ਖਰਾਬੀ ਨਾ ਹੋਵੇ ਹਾਂਜੀ ਇਹ ਤੁਸੀਂ ਦੱਸੋ ਵੀ ਇਸ ਵੇਲੇ ਕਿ ਕਿਹੜੀ ਜਗ੍ਹਾ ਜੇ ਅਤੇ ਕਿੰਨੇ ਚਿਰ 'ਚ ਸਾਡੇ ਕੋਲ ਆਊਗੇ ਮਿਹਰਬਾਨੀ ਜੀ ਮਿਹਰਬਾਨੀ